ਸਾਨੂੰ ਯੋਗਾ ਘੱਟ ਤੋਂ ਘੱਟ ਇਕ ਘੰਟਾ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਸਰੀਰ ਬਹੁਤ ਹੀ ਵਧੀਆ ਰਿਜਲਟ ਸਾਨੂੰ ਦਿੰਦਾ ਹੈ ਸਾਨੂੰ ਯੋਗਾ ਸਵੇਰੇ ਸਵੇਰੇ ਉੱਠਦੇ ਸਾਰ ਥੋੜ੍ਹਾ ਜਿਹਾ ਫਰੈਸ਼ ਹੋ ਕੇ ਕਰਨਾ ਚਾਹੀਦਾ ਹੈ ਅਤੇ ਸਾਨੂੰ ਇਹ ਖੁੱਲ੍ਹੀ ਤਾਜ਼ੀ ਹਵਾ ਵਿੱਚ ਕਰਨਾ ਚਾਹੀਦਾ ਹੈ ਜਿੱਥੇ ਕਿ ਸਵੇਰੇ ਸਵੇਰ ਦੀ ਤਾਜ਼ੀ ਹਵਾ ਬਹੁਤ ਹੀ ਵਧੀਆ ਆਉਂਦੀ ਹੋਵੇ ਜਿਵੇਂ ਕਿ ਅਸੀਂ ਛੱਤ 'ਤੇ ਘਰਾਂ ਦੇ ਗਰਾਊਂਡ ਵਿੱਚ ਘਰਾਂ ਦੇ ਆਂਗਨ ਵਿੱਚ ਘਰਾਂ ਦੇ ਬਗੀਚਿਆਂ ਵਿੱਚ ਬੈਠ ਕੇ ਕਰ ਸਕਦੇ ਹਾਂ ਸ਼ਹਿਰਾਂ ਵਿੱਚ ਇਹ ਥਾਂ ਸਾਨੂੰ ਛੱਤ 'ਤੇ ਹੀ ਮਿਲਦੀ ਹੈ ਛੋਟੇ ਛੋਟੇ ਘਰ ਹੋਣ ਦੇ ਵਜ੍ਹਾ ਨਾਲ ਸਾਨੂੰ ਛੱਤ 'ਤੇ ਆ ਆ ਆਪਣੇ ਕਮਰੇ ਦੇ ਵਿੱਚ ਹੀ ਕਰ ਸਕਦੇ ਹਾਂ ਯੋਗਾ ਸਾਨੂੰ ਇੱਕ ਘੰਟਾ ਕਰਨਾ ਚਾਹੀਦਾ ਹੈ ਧੰਨਵਾਦ